ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਜੋਤ ਕੌਰ ਹੈ ਮੈਂ ਪੰਜ ਕੁ ਮਿੰਟ ਪਹਿਲਾਂ ਤੁਹਾਡੀ ਸਭਲੋਕ ਸਵੀਟਸ ਤੋਂ ਔਡਰ ਕੀਤਾ ਸੀ ਜਿਸ ਵਿਚ ਜਿਸ ਵਿੱਚ ਕੇਕ ਅਤੇ ਕੁਛ ਮਿਠਾਈਆਂ ਸ਼ਾਮਿਲ ਸਨ ਮੈਨੂੰ ਇਸਦੀ ਪੇਮੈਂਟ ਵੀ ਤੁਹਾਨੂੰ ਉਸੀ ਸਮੇਂ ਕਰ ਦਿੱਤੀ ਸੀ ਪਰ ਮੈਨੂੰ ਹੁਣ ਤੁਹਾਡੀ ਦੁਕਾਨ ਵੱਲੋਂ ਮੈਸਿਜ ਰਸੀਵ ਹੋਇਆ ਕਿ ਤੁਹਾਨੂੰ ਪੇਮੈਂਟ ਨਹੀਂ ਪਹੁੰਚੀ ਹੈ ਮੈਂ ਤੁਹਾਨੂੰ ਇਸਦਾ ਸਕ੍ਰੀਨਸ਼ੋਟ ਵੀ ਸੈਂਡ ਕਰ ਦਿੱਤਾ ਹੈ ਕਿਰਪਾ ਕਰਕੇ ਤੁਸੀਂ ਚੈੱਕ ਕਰ ਲਵੋ ਮੈਨੂੰ ਪਤਾ ਲੱਗਾ ਕਿ ਤੁਹਾਡੇ ਕੋਲ ਪੇਮੈਂਟ ਨਹੀਂ ਪਹੁੰਚੀ ਪਰ ਮੈਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਪੇਮੈਂਟ ਕਿਉਂ ਨਹੀਂ ਪਹੁੰਚੀ ਮੈਨੇ ਆਪਣੇ ਵੱਲੋਂ ਤੁਹਾਨੂੰ ਪੇਮੈਂਟ ਕਰ ਦਿੱਤੀ ਸੀ ਜੇਕਰ ਤੁਹਾਡੇ ਕੋਲ ਥੋੜ੍ਹੀ ਦੇਰ ਤੱਕ ਤੁਸੀਂ ਵੇਟ ਕਰ ਲਉ ਜੇਕਰ ਤੁਹਾਡੇ ਕੋਲ ਫਿਰ ਵੀ ਪੇਮੈਂਟ ਨਾ ਪਹੁੰਚੀ ਆਪਾਂ ਇਸਦਾ ਬਾਅਦ ਵਿੱਚ ਕੋਈ ਹੱਲ ਕਰ ਦੇਵਾਂਗੇ